ਬ੍ਰਹਿਮੰਡ ਦੇ ਹੋਰ ਗ੍ਰਹਿਆਂ 'ਤੇ ਜੀਵਨ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਇਸ ਬਾਰੇ ਸਾਇੰਸ ਆਪਣੇ ਕੰਮ ਕਰ ਰਹੀ ਹੈ ਮੰਗਲ ਗ੍ਰਹਿ ਚੰਦ ਚੰਦਰਮਾ 'ਤੇ ਜੇ ਪਾਣੀ ਅਤੇ ਹਵਾ ਮਿਲਦੀ ਹੈ ਜੋ ਕਿ ਜੀਵਨ ਨੂੰ ਜਿਉਣ ਲਈ ਜ਼ਰੂਰੀ ਹੈ ਤਾਂ ਇਨ੍ਹਾਂ ਗ੍ਰਹਿਆਂ 'ਤੇ ਜੀਵਨ ਹੋ ਸਕਦਾ ਹੈ ਇਸ ਬਾਰੇ ਸਾਇੰਸ ਆਪਣਾ ਪੂਰਾ ਜ਼ੋਰ ਲਾ ਰਹੀ ਹੈ ਅਤੇ ਉਮੀਦ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਉਹ ਆਪਣੇ ਇਸ ਕੰਮ ਵਿੱਚ ਸਫਲ ਹੋ ਜਾਣਗੇ